ਜਦੋਂ ਤੋਂ ਮੈਂ ਯੋਗਾ ਕਰਨ ਲੱਗੀ ਹਾਂ ਮੇਰਾ ਸਰੀਰ ਬੜਾ ਤੰਦਰੁਸਤ ਹੋ ਗਿਆ ਹੈ ਸਰੀਰ ਬਹੁਤ ਫਿਟ ਹੋ ਗਿਆ ਹੈ ਮੈਂ ਕੋਈ ਵੀ ਕੰਮ ਬੜੀ ਫੁਰਤੀ ਨਾਲ ਕਰ ਲੈਂਦੀ ਹਾਂ ਯੋਗਾ ਨਾਲ ਮੈਂ ਬਿਮਾਰੀਆਂ ਤੋਂ ਦੂਰ ਹੋ ਗਈ ਹਾਂ ਕਿਸੀ ਵੀ ਕੰਮ ਕਰਨ ਨੂੰ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਉਂਦਾ ਆਉਂਦੀ ਇਸ ਲਈ ਯੋਗਾ ਮੇਰੇ ਸਰੀਰ ਲਈ ਬਹੁਤ ਲਾਭਦਾਇਕ ਹੈ ਧੰਨਵਾਦ